ਸਤਿ ਸ਼੍ਰੀ ਅਕਾਲ ਜੀ ਕਾਰੋਬਾਰੀ ਜਿਹੜੇ ਹੈਗੇ ਆਪਣੇ ਉਤਪਾਦਾਂ ਨੂੰ ਅਤੇ ਆਪਣੀ ਸੰਚਾਲਨ ਨੂੰ ਕਾਰੋਬਾਰ ਨੂੰ ਵਧਾਉਣ ਦੇ ਲਈ ਹਮੇਸ਼ਾ ਹੀ ਟੈਕਨੋਲੋਜੀ ਦੇ ਨਾਲ ਹੀ ਚੱਲਦੇ ਆ ਜੀ ਅਤੇ ਨਾਲ ਚੱਲਣ 'ਚ ਫਾਇਦਾ ਹੈਗਾ ਕਿਉਂਕਿ ਟੈਕਨੋਲੋਜੀ ਦੇ ਨਾਲ ਚੱਲਾਂਗੇ ਤਾਂ ਆਪਣਾ ਕੰਮ ਵੀ ਵਧੀਆ ਹੋਊਗਾ ਤਾਂ ਆਪਾਂ ਨੂੰ ਪ੍ਰੋਡਕਟੀਵਿਟੀ ਜਿਹੜੀ ਹੈਗੀ ਉਤਪਾਦਕਤਾ ਉਹ ਵੱਧ ਤੋਂ ਵੱਧ ਮਿਲੇਗੀ ਜਿਵੇਂ ਜੀ ਪਹਿਲਾਂ ਵੀ ਆਪਾਂ ਹਮੇਸ਼ਾ ਹੀ ਮਸ਼ੀਨਾਂ ਦਾ ਯੂਜ਼ ਕਰ ਜਿਵੇਂ ਜਿਵੇਂ ਨਵੀਂ ਨਵੀਆਂ ਨਵੀਆਂ ਨਵੀਆਂ ਟੈਕਨੋਲੋਜੀ ਦੀਆਂ ਮਸ਼ੀਨਾਂ ਆਉਂਦੀ ਗਈਆਂ ਸੀ ਉਹਨਾਂ ਨੂੰ ਜਿੰਨੇ ਕਾਰੋਬਾਰੀ ਸੀ ਉਹ ਆਪਦੇ ਆਪਦੇ ਸੈਕਟਰ ਦੇ ਵਿੱਚ ਆਪਣੇ ਆਪਣੇ ਫੀਲਡ ਦੇ ਵਿੱਚ ਲੈ ਕੇ ਖੇਤਰ ਦੇ ਵਿੱਚ ਲੈ ਕੇ ਉਹਨੂੰ ਯੂਜ ਕਰਕੇ ਅਤੇ ਆਪਣੀ ਪ੍ਰੋਡਕਟੀਵਿਟੀ ਨੂੰ ਉਤਪਾਦਕਤਾ ਨੂੰ ਵਧਾ ਕੇ ਅਤੇ ਮੇਨ ਪਾਵਰ ਨੂੰ ਘੱਟ ਕਰਕੇ ਸਮਾਰਟ ਵਰਕ ਕਰਦੇ ਸੀ ਅਤੇ ਅੱਜ ਕੱਲ੍ਹ ਤਾਂ ਫੇਰ ਵੀ ਜਿਵੇਂ ਸੋਫਟਵੇਅਰ ਐਪਲੀਕੇਸ਼ਨ ਦੇ ਉੱਤੇ ਰੋਬੋਟ ਜਿਵੇਂ ਆਏ ਜਿਵੇਂ ਆਰਟੀਫਿਸ਼ਅਲ ਇੰਟੈਲੀਜੈਂਸ ਆ ਗਈ ਇਹ ਸਾਰੀਆਂ ਚੀਜ਼ਾਂ ਨੇ ਕੰਮ ਜਮਾਂ ਹੀ ਸਮੂਥ ਕਰਤਾ ਹਰ ਇੱਕ ਚੀਜ਼ ਅੱਜ ਕੱਲ੍ਹ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਆਪਾਂ ਚੈਟ ਜੀ ਪੀ ਟੀ ਤੋਂ ਪੁੱਛ ਸਕਦੇ ਹਨ ਅਤੇ ਕੋਈ ਵੀ ਆਪਣਾ ਡਾਊਟ ਹੋਵੇ ਚਾਹੇ ਉਹ ਟੀਚਿੰਗ ਪ੍ਰੋਫੈਸ਼ਨ ਹੈਗਾ ਕਾਰੋਬਾਰ ਜਿਵੇਂ ਕੋਈ ਸਕੂਲ ਖੋਲ੍ਹਦਾ ਜਾਂ ਕੋਈ ਚੀਜ਼ ਬਣਾਉਣ ਵਾਲੀ ਕੰਪਨੀ ਹੈ ਜਾਂ ਕੋਈ ਚਾਦਰਾਂ ਬਣਾਉਂਦੇ ਜਾਂ ਕੋਈ ਵੀ ਚੀਜ਼ ਆਪਾਂ ਜਿੱਥੇ ਵੀ ਹੈਗੇ ਉੱਥੇ ਇਹ ਜਿਹੜੀਆਂ ਨਵੀਆਂ ਟੈਕਨੋਲੋਜੀਆਂ ਉਹਨਾਂ ਨੂੰ ਯੂਜ਼ ਕਰਕੇ ਕਾਰੋਬਾਰੀ ਆਪਣੀ ਉਤਪਾਦਕਤਾ ਨੂੰ ਪ੍ਰੋਡਕਟੀਵਿਟੀ ਨੂੰ ਪੀਕ ਲੈਵਲ 'ਤੇ ਲੈ ਕੇ ਜਾ ਸਕਦੇ ਨੇ ਧੰਨਵਾਦ